ਹੈਲੋ ਹਾਂਜੀ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਸਾਰੇ ਹੋਰ ਤੁਸੀਂ ਦੱਸੋ ਪਰਿਵਾਰ ਠੀਕ ਆ ਹੋਰ ਅੱਛਾ ਜੀ ਗੁੜ ਬਾਰੇ ਹਾਂਜੀ ਗਰਮੀਆਂ 'ਚ ਵੀ ਇਨਾ ਹੈ ਨਹੀ ਗਾ ਵੈਸੇ ਹੈਗਾ ਵੀ ਆ ਤੇ ਨਹੀਂ ਵੀ ਸਰਦੀਆਂ ਚ ਤਾਂ ਕੋਈ ਮਤਲਬ ਕਿ ਨੁਕਸਾਨ ਵਾਲੀ ਕੋਈ ਗੱਲ ਹੀ ਹੈ ਨਹੀਂ ਕਿਉਂਕਿ ਸਰਦੀਆਂ 'ਚ ਤਾਂ ਫਿਰ ਆਪਾਂ ਨੂੰ ਗੁੜ ਜਿਆਦਾ ਸੇਵਨ ਕਰਨਾ ਨਹੀਂ ਚਾਹੀਦਾ ਹੈਗਾ ਹਾਂ ਸਰਦੀਆਂ ਦੇ ਵਿੱਚ ਆਪਾਂ ਜਿਵੇਂ ਆਪਾਂ ਗੁੜ ਵਾਲੀ ਚਾਹ ਪੀ ਲਈ ਤਾਂ ਵੀ ਕੋਈ ਦਿੱਕਤ ਹੀ ਨਹੀਂ ਗੀ ਉਹਦੇ ਨਾਲ ਸਿਰ ਦਰਦ ਵੀ ਸਹੀ ਰਹਿੰਦਾ ਗਾ ਇਹ ਵੀ ਆਹ ਪੇਟ ਵੀ ਸਾਫ ਰਹਿੰਦਾ ਗੁੜ ਨਾਲ ਤੇ ਰੋਟੀ ਤੋਂ ਬਾਅਦ ਵੀ ਆਪਾਂ ਨੂੰ ਮਤਲਬ ਕਿ ਥੋੜਾ ਜਿਹਾ ਗੁੜ ਖਾਣਾ ਚਾਹੀਦਾ ਗਾ ਹਾਂ ਹਾਂਜੀ ਗਰਮੀ 'ਚ ਗੁੜ ਐਂ ਆ ਨਾ ਗਰਮੀ 'ਚ ਜਿਹੜੀ ਗੁੜ ਦੀ ਤਸੀਰ ਹੁੰਦੀ ਆ ਉਹ ਗਰਮ ਹੁੰਦੀ ਹੈ ਤੇ ਗਰਮੀ 'ਚ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਹੈਗੀ ਵੀ ਆਪਾਂ ਜਿਆਦਾ ਨਹੀਂ ਵੀ ਥੋੜਾ ਜਿਹਾ ਵੀ ਨਾ ਮਾਤਰ ਜਾਵੇ ਜਿਵੇਂ ਹੁੰਦਾ ਜਿਵੇਂ ਆਪਾਂ ਸੇਵ ਕਰ ਲਈਏ ਅੱਧੀ ਵਾਰ ਕੋਈ ਨੀ ਰੋਜਾਨਾ ਖਾਂਦੇ ਆ ਫਿਰ ਪੇਟ 'ਚ ਇਨਫੈਕਸ਼ਨ ਹੋ ਜਾਂਦੀ ਆ ਗਰਮੀ ਪੈ ਜਾਂਦੀ ਆ ਤੇ ਤਾਂ ਕਰਕੇ ਦਿੱਕਤ ਆਉਣ ਲੱਗ ਜਾਂਦੀ ਹ ਵੀ ਸਰਦੀਆਂ 'ਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਭਾਵੇਂ ਰੋਜ਼ਾਨਾ ਖਾ ਲਈਏ ਹਾਂਜੀ ਬਾਕੀ ਜਿਵੇਂ ਹਾਂਜੀ ਹਾਂਜੀ ਬਾਕੀ ਜਿਵੇਂ ਹਾਂ ਸਰਦੀਆਂ 'ਚ ਇਹਦੇ ਮਤਲਬ ਕਿ ਜਿਵੇਂ ਗੱਚਕ ਖਾ ਲਈ ਤੇ ਰਿਉੜੀਆਂ ਹੋ ਗਈਆਂ ਤੇ ਹਾਂ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਹਨਾ ਹਾਂ

ਹਾਂ ਇਹਦੇ ਨੁਕਸਾਨ ਇਹ ਹੈਗੇ ਵੀ ਨੁਕਸਾਨ ਤਾਂ ਵੈਸੇ ਹੈ ਨੀ ਗੇ ਸਰਦੀਆ 'ਚ ਜੇ ਮੰਨ ਕੇ ਚਲੋ ਕਿਸੇ ਦਾ ਆਪਰੇਸ਼ਨ ਹੋਇਆ ਹਨਾ ਤੇ ਬੰਦਾ ਉਹਨੂੰ ਡਾਕਟਰ ਸਲਾਹ ਦਿੰਦੇ ਵੀ ਗੁੜ ਵਾਲੀਆਂ ਸੇਵੀਆਂ ਖਾਣੀਆਂ ਚਾਹੀਦੀਆਂ ਵੀ ਗੁੜ ਵਾਲੀਆਂ ਸੇਵੀਆਂ ਹੀ ਤੁਸੀਂ ਸਹੀ ਰਹਿੰਦੀਆਂ ਅੱਖਾਂ ਦੇ ਸਿਹਤ ਵਾਸਤੇ ਹਾਂਜੀ ਹਾਂਜੀ ਗੁੜ ਤੇ ਬਹੁਤ ਸਾਰੇ ਫਾਇਦੇ ਆਗੇ ਹਾਂ ਗੁੜ ਵਿੱਚ ਕੈਮੀਕਲ ਤਾਂ ਬਹੁਤ ਜਿਆਦਾ ਹੁੰਦੇ ਹੈਗੇ ਵੀ ਜਿਹੜਾ ਫੈਕਟਰੀ 'ਚ ਗੁੜ ਬਣਾਇਆ ਜਾਂਦਾ ਉਹਨਾਂ 'ਚ ਕੈਮੀਕਲ ਹੁੰਦੇ ਆ ਜਿਹੜੇ ਮੰਨ ਕੇ ਚੱਲੋ ਵੀ ਬਣਾਉਦੀਆਂ ਨੇ ਹਨਾ ਵੀ ਗੰਨਾਂ ਜਿਹੜਾ ਸ਼ੁੱਧ ਸਹੀ ਹੁੰਦਾ ਉਹਦੇ ਰਾਹੀਂ ਜਿਹੜਾ ਬਣਾਉਂਦੇ ਆ ਉਹ ਸਾਰਿਆਂ ਨਾਲ ਵਧੀਆ ਹੁੰਦਾ ਹਾ ਕੁਲਾੜੀ ਆਲਾ ਗੁੜ ਹਾਂਜੀ

ਹਾਂ ਰੋਟੀ ਤੋਂ ਬਾਅਦ ਆਪਾਂ ਨੂੰ ਗੁੜ ਵਾਲਾ ਸੇਵਨ ਕਰਨਾ ਚਾਹੀਦਾ ਇਹਦੇ ਲਈ ਸਾਰਿਆਂ ਨਾਲੋਂ ਵਧੀਆ ਸਰਦੀਆਂ ਚ ਠੀਕ ਹੈ ਜੀ